ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਸਾਡੀਆਂ ਇੰਜ ਹੁੰਦੀਆਂ ਜਿਸ ਤਰ੍ਹਾਂ ਅਸੀਂ ਪੰਜਾਬੀ ਲਿਖਦੇ ਹਾਂ ਬੋਲਦੇ ਹਾਂ ਸਾਡੀ ਬੋਲਣ ਵਿੱਚ ਅਲੱਗ ਹੁੰਦੀ ਹੈ ਲਿਖਣ ਵਿੱਚ ਅਲੱਗ ਹੁੰਦੀ ਹੈ ਪੰਜਾਬੀ ਭਾਸ਼ਾ ਸਾਡੀ ਬਹੁਤ ਵਧੀਆ ਹੁੰਦੀ ਹੈ ਪੰਜਾਬੀ ਬੋਲਣ ਵਿੱਚ ਸਾਨੂੰ ਬਹੁਤ ਹੀ ਵਧੀਆ ਲੱਗਦੀ ਹੈ ਲਿਖਣ ਵਿੱਚ ਵੀ ਸਾਨੂੰ ਵਧੀਆ ਲੱਗਦੀ ਹੈ ਅਤੇ ਜਦੋਂ ਅਸੀਂ ਬੋਲਦੇ ਹਾਂ ਸਾਨੂੰ ਵਧੀਆ ਲੱਗਦਾ ਲਿਖਣ ਵਿੱਚ ਸਾਡੇ ਕੋਲ ਕਈ ਗਲਤੀਆਂ ਹੋ ਜਾਂਦੀਆਂ ਪੰਜਾਬੀ 'ਚ ਬੋਲਣ 'ਚ ਵੀ ਹੋ ਜਾਂਦੀ ਹੈ ਲਿਖਣ ਵਿੱਚ ਵੀ ਹੋ ਜਾਂਦੀ ਆ ਅਤੇ ਇਹਦੀਆਂ ਵਿਸ਼ੇਸ਼ਤਾਵਾਂ ਬੜੇ ਬੜੀਆਂ ਦਿੱਤੀਆਂ ਹੁੰਦੀਆਂ ਵਿਆਕਰਨ ਵੀ ਕਰਦੇ ਹਾਂ ਅਸੀਂ ਪੰਜਾਬੀ ਨੂੰ ਬੋਲਣ ਵਿੱਚ ਸਾਨੂੰ ਸਹੀ ਲੱਗਦੀ ਹੈ ਸਾਡਾ ਪੰਜਾਬੀ ਕਲਚਰ ਆ ਅਸੀਂ ਪੰਜਾਬ ਵਿੱਚ ਪੰਜਾਬੀ ਹੀ ਸਾਨੂੰ ਵਧੀਆ ਲੱਗਦੀ ਹੈ ਬੋਲ ਸਕਦੇ ਹਾਂ ਅਸੀਂ ਪੰਜਾਬੀ ਤੋਂ ਸਾਨੂੰ ਬਹੁਤ ਕੁਛ ਮਿਲਦਾ ਸਿੱਖਣ ਨੂੰ ਪੜ੍ਹਨ ਨੂੰ ਬੜਾ ਕੁਛ ਹੁੰਦਾ ਪੰਜਾਬੀ ਸਾਨੂੰ ਆਉਣੀ ਹੀ ਚਾਹੀਦੀ ਹੈ ਪੰਜਾਬੀ ਸਾਡਾ ਇੱਕ ਹਿੱਸਾ ਵਾ ਸਾਡੀ ਲਾਈਫ ਆ ਪੰਜਾਬੀ ਸਾਡਾ ਕਲਚਰ ਆ ਬੜਾ ਕੁਛ ਹੈ ਪੰਜਾਬੀ ਵਿੱਚ ਸਿੱਖਣ ਨੂੰ ਮਿਲਦਾ ਹੈ ਪੰਜਾਬੀ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਆਉਂਦੀ ਆ ਸਾਨੂੰ ਅਸੀਂ ਸਕੂਲ ਜਾਂਦੇ ਹਾਂ ਅਤੇ ਪੰਜਾਬੀ ਹੀ ਜ਼ਰੂਰੀ ਹੋਣੀ ਚਾਹੀਦੀ ਆ ਉੱਥੇ ਸਾਨੂੰ ਪੰਜਾਬੀ ਆਉਣੀ ਚਾਹੀਦੀ ਹੈ ਜਿਸ ਤਰ੍ਹਾਂ ਵੀ ਕਰਕੇ ਸਾਨੂੰ ਅਸੀਂ ਪ੍ਰਾਈਵੇਟ ਸਕੂਲ 'ਚ ਵੀ ਪੜ੍ਹਦੇ ਹਾਂ ਤਾਂ ਸਾਡੇ ਲਈ ਪੰਜਾਬੀ ਬਹੁਤ ਜ਼ਰੂਰੀ ਹੈ ਪੰਜਾਬੀ ਇੱਕ ਇਹੋ ਜਿਹੀ ਭਾਸ਼ਾ ਕਿ ਸਾਨੂੰ ਆਉਣੀ ਚਾਹੀਦੀ ਬੋਲਣ ਵਿੱਚ ਲਿਖਣ ਵਿੱਚ ਹਰ ਇੱਕ ਪ੍ਰਕਾਰ 'ਚ ਸਾਨੂੰ ਪੰਜਾਬੀ ਆਉਣੀ ਚਾਹੀਦੀ ਜਿਸ ਤਰ੍ਹਾਂ ਦੀ ਮਰਜ਼ੀ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਪੰਜਾਬੀ ਆਉਣੀ ਚਾਹੀਦੀ ਹੈ ਬੱਚੇ ਨੂੰ ਅੱਜ ਕੱਲ੍ਹ ਸਕੂਲਾਂ ਵਿੱਚ ਕੀ ਕਰਦੇ ਆ ਕਿ ਜ਼ਿਆਦਾ ਹਿੰਦੀ ਇੰਗਲਿਸ਼ ਚਲਦੀ ਹੈ ਨਹੀਂ ਸਾਡੀ ਪੰਜਾਬੀ ਬਹੁਤ ਜ਼ਰੂਰੀ ਹੈ ਪੰਜਾਬੀ ਸਿੱਖਣੀ ਹੀ ਚਾਹੀਦੀ ਹੈ ਪੰਜਾਬੀ ਆਉਣੀ ਹੀ ਚਾਹੀਦੀ ਹੈ ਬੱਚਿਆਂ ਨੂੰ ਤਾਂ ਕਿ ਬੱਚੇ ਨੂੰ ਹਰ ਇੱਕ ਸਮਝ ਆ ਸਕੇ